ਵਿਗਿਆਨ ਸਬੂਤ ਦੇ ਅਧਿਆ ਅਧਾਰ 'ਤੇ ਇੱਕ ਵਿਵਸਥਿਤ ਕਾਰਜ ਪ੍ਰਣਾਲੀ ਦੀ ਪਾਲਣਾ ਕਰਦੇ ਹੋਏ ਕੁਦਰਤ ਅਤੇ ਸਮਾਜਿਕ ਸੰਸਾਰ ਦੇ ਗਿਆਨ ਅਤੇ ਸਮਝ ਦੀ ਖੋਜ ਅਤੇ ਉਪਯੋਗ ਹਨ ਹੈ ਵਿਗਿਆਨ ਕਾਰਜ ਪ੍ਰਣਾਲੀ ਵਿੱਚ ਹੇਠ ਲਿਖੀਆਂ ਸ਼ਾਮਿਲ ਹਨ ਉਦੇਸ਼ ਨਿਰੀਖਣ ਮਾਪ ਅਤੇ ਡੇਟਾ ਸਬੂਤ ਵਿਗਿਆਨ ਵਿਗਿਆਨ ਨੇ ਬਹੁਤ ਸਾਰੀਆਂ ਕਾਢ ਕੱਢੀਆਂ ਹਨ ਜਿਵੇਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ ਹਾਂ ਜਿਸ ਕਰਕੇ ਹਰ ਕੰਮ ਕਰਨਾ ਸੌਖਾ ਹੋ ਗਿਆ ਹੈ ਹੱਥੀਂ ਕੰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਕਿ ਬਿਜਲੀ ਬਿਜਲੀ ਦੀ ਖੋਜ ਕੀਤੀ ਹੈ ਅਤੇ ਹੋਰ ਮਸ਼ੀਨਾਂ ਦੀ ਖੋਜ ਕੀਤੀ ਹੈ ਜਿਸ ਕਰਕੇ ਸਾਨੂੰ ਅਸੀਂ ਘਰ ਬੈਠੇ ਕੋਈ ਵੀ ਕੰਮ ਕਰ ਸਕਦੇ ਹਾਂ ਜਿਵੇਂ ਕਿ ਪੈਸਾ ਹੈ ਘਰ ਬੈਠੇ ਹੀ ਪੈਸਾ ਟ੍ਰਾਂਸਫਰ ਕਰ ਸਕਦੇ ਆਂਗੇ ਕੋਈ ਵੀ ਕੰਮ ਆਨਲਾਈਨ ਕਰ ਸਕਦੇ ਹਾਂਗੇ ਕਾਰਡ ਬਣਾ ਆਨਲਾਈਨ ਕਾਰਡ ਬਣਾ ਸਕਦੇ ਹਾਂਗੇ ਇੱਦਾਂ ਦੇ ਕੰਮ ਅਸੀਂ ਘਰ ਬੈਠੇ ਕਰ ਸਕਦੇ ਹਾਂ ਜਿਸ ਕਰਕੇ ਸਾਨੂੰ ਇਹ ਟੈਕਨੋਲੋਜੀ ਦੇ ਤੌਰ 'ਤੇ ਸ ਸਾਰਾ ਕੰਮ ਕਰਨਾ ਸੌਖਾ ਹੋ ਗਿਆ ਹੈ ਇਸ ਲਈ ਸਾਡੇ ਲਈ ਟੈਕਨੋਲੋਜੀ ਬਹੁਤ ਫ਼ਾਇਦੇਮੰਦ ਹੋ ਚੁੱਕੀ ਹੈ ਅਤੇ ਘੱਟ ਸਮਾਂ ਬਰਬਾਦ ਹੁੰਦਾ ਹੈ ਜੇ ਮੈਂ ਜਾਣਨਾ ਚਾਹੂੰ ਜੇ ਮੈਂ ਕਿਸੇ ਵਿਗਿਆਨ ਤੋਂ ਜਾਣਨਾ ਚਾਹੂੰਗੀ ਕਿ ਟੈਕਨੋਲੋਜੀ ਹੋਰ ਕੀ ਫ਼ਾਇਦੇਮੰਦ ਹੈ ਜਾਂ ਗੂਗਲ 'ਤੇ ਸਰਚ ਕਰ ਸਕਦੀ ਹਾਂ